ਜਦੋਂ ਕਲਾ ਅਤੇ ਹਸਤ ਤੋਂ ਸੰਵਾਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਿਲਾਈ ਅਤੇ ਬੁਣਾਈ ਦੀਆਂ ਤਕਨੀਕਾਂ ਨੂੰ ਆਪਣਾ ਮਹੱਤਵਪੂਰਨ ਸਮਝਦੇ ਹਾਂ ਇਹਨਾਂ ਤਕਨੀਕਾਂ ਨੇ ਮੇਰੀ ਕਲਾ ਵਿੱਚ ਖਾਸ ਤੌਰ 'ਤੇ ਰਚਨਾਤਮਕਤਾ ਵਿਅਕਤੀਗਤ ਅਸਥਗਿਤਾ ਨੂੰ ਸ਼ਾਮਿਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਮੈਂ ਜਿਹੜੀਆਂ ਵਿਸ਼ੇਸ਼ ਤਕਨੀਕਾਂ ਨੂੰ ਵਰਤਿਆ ਹੈ ਉਹਨਾਂ ਵਿੱਚ ਕੁਝ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਸਿਲਾਈ ਅਤੇ ਬੁਣਾਈ ਪ੍ਰਕਿਰਿਆਵਾਂ ਹਨ ਕਰੋਸ਼ੇਟ ਕਰੋਸ਼ੇਟ ਮੇਰੇ ਲਈ ਇੱਕ ਮਹੱਤਵਪੂਰਨ ਤਕਨੀਕ ਹੈ ਜੋ ਕਿ ਮੇਰੀ ਕਲਾ ਨੂੰ ਨਵਾਂ ਰੂਪ ਦਿੰਦੀ ਹੈ ਇਸ ਤਕਨੀਕ ਵਿੱਚ ਧਾਗੇ ਦੀ ਨੂੰ ਇੱਕ ਵਿਸ਼ੇਸ਼ ਸੰਗਠਨ ਵਿੱਚ ਬੁਣਿਆ ਜਾਂਦਾ ਹੈ ਜੋ ਕਿ ਖੂਬਸੂਰਤ ਡਿਜਾਈਨ ਬੁਣਨ ਵਿੱਚ ਮਦਦ ਕਰਦਾ ਹੈ ਇਹਨਾਂ ਜਾਦੂਕ ਦੇ ਕੰਮਾਂ ਦੇ ਜ਼ਰੀਏ ਅਸੀਂ ਇੱਕ ਪਰਜ਼ ਬਣਾਉਂਦੇ ਹਨ ਜਿਸ ਵਿੱਚ ਪ੍ਰਾਚੀਨ ਅਤੇ ਆਧੁਨਿਕ ਤਕਨੀਕਾਂ ਦਾ ਮਿਲਾਪ ਹੁੰਦਾ ਹੈ ਕਰੈਸ਼ਟ ਨਾਲ ਮੈਂ ਕਈ ਰੰਗ ਅਤੇ ਧਾਗੇ ਨਾਲ ਨਵੇਂ ਮਾਡਲ ਅਤੇ ਡਿਜ਼ਾਇਨ ਬਣਾਉਂਦਾ ਹਾਂ ਜੋ ਕਿ ਕਲਾ ਨੂੰ ਬਹੁਤ ਮਜ਼ਬੂਤ ਬਣਾਉਂਦਾ ਹੈ ਹੈਂਡ ਐਮਬਰਾਇਡਰੀ ਇੱਕ ਵਿਸ਼ੇਸ਼ ਤਕਨੀਕ ਹੈ ਜਿਸ ਨੇ ਮੈਨੂੰ ਅਗਲੇ ਸਤਰ ਤੱਕ ਪਹੁੰਚਾਇਆ ਹੈ ਇਹ ਤਕਨੀਕ ਧੀਰਜ ਅਤੇ ਖੁਦ ਦੇ ਕੰਮ ਨੂੰ ਸੰਪੂਰਨਤਾ ਨਾਲ ਜੋੜਦੀ ਹੈ ਜਿੱਥੇ ਹਰ ਸਿਲਾਈ ਨੂੰ ਆਪਣੇ ਆਪ ਵਿੱਚ ਇੱਕ ਮੰਨਿਆ ਗਿਆ ਹੈ ਉੱਥੇ ਇੱਕ ਹੁਣ ਪੈਚਵਰਕ ਦੀ ਕਲਾ ਵੀ ਬਹੁਤ ਮਹੱਤਵਪੂਰਨ ਹਿੱਸਾ ਬਣ ਗਈ ਹੈ ਪੈਚਵਰਕ ਦੀ ਤਕਨੀਕਾਂ ਵਿੱਚ ਬਹੁਤ ਮਹੱਤਵਪੂਰਨ ਹੈ ਇਸ ਨੂੰ ਮੁਸ਼ਕਲ ਨਕਸ਼ਾ ਜਾਂ ਕਲਾ ਰਚਨਾ ਦੇ ਤੌਰ 'ਤੇ ਪੇਸ਼ ਹੁੰਦੀ ਹੈ ਇਹ ਤਕਨੀਕਾਂ ਮੇਰੀ ਕਲਾ ਨੂੰ